ਪੋਲਟਰੀ ਉਤਪਾਦਾ ਦੇ ਕੁਛ ਕੁ ਪ੍ਰੋਸੈਸਿੰਗ ਦੇ ਆਮ ਤਰੀਕੇ ਹਨ ਜਿਵੇਂ ਕੀ ਪਹਿਲਾਂ ਮੁਰਗੀ ਨੂੰ ਪਾਲਿਆ ਜਾਂਦਾ ਹੈ ਫਿਰ ਜਦੋਂ ਮੁਰਗੀ ਵੱਡੀ ਹੋ ਜਾਂਦੀ ਹੈ ਤਾਂ ਉਸਨੂੰ ਜਿਵੇਂ ਕੀ ਮੀਟ ਬਣਾਉਣ ਦੇ ਕੰਮ ਲਈ ਵਰਤਿਆ ਜਾਂਦਾ ਹੈ ਸਭ ਤੋਂ ਪਹਿਲਾਂ ਉਨ ਉਹਨੂੰ ਪਾਲ ਕੇ ਫਿਰ ਉਸ ਦਾ ਕਤਲ ਕੀਤਾ ਜਾਂਦਾ ਹੈ ਫਿਰ ਕਸਾਈ ਉਸਨੂੰ ਵੱਡਦਾ ਹੈ ਤੇ ਉਸਦਾ ਮੀਟ ਬਣਾ ਕੇ ਵੇਚਦਾ ਹੈ ਤੇ ਫਿਰ ਲੋਕ ਉਸਨੂੰ ਬਣਾ ਕੇ ਪਕਾ ਕੇ ਮਤਲਬ ਖਾਣ ਖਾਣ ਲਈ ਵਰਤਦੇ ਹਨ ਇਸ ਤਰਾਂ ਪੋਲਟਰੀ ਉਤਪਾਦਾ ਦੀ ਪ੍ਰੋਸੈਸਿੰਗ ਚਲਦੀ ਹੈ